ਲੋਕ ਲੋਕ ਕਿੱਤੇ ਲੋਕ ਕਿੱਤੇ ਪ੍ਰਧਾਨ ਕਾਲ ਤੋਂ ਹੀ ਮਨੁਖਤੀ ਜੀਵਨ ਜੀਵਨ ਜਾਂਦਾ ਦਾ ਅੰਗ ਰਹੇ ਹਨ ਇਹਨਾਂ ਦਿਨਾਂ ਦੇ ਇਹਨਾਂ ਦੇ ਵਿਕਾਸ ਕਰਨ ਲਈ ਸਮਾਜ ਦਾ ਵਿਕਾਸ ਹੋਇਆ ਹੈ ਲੋੜਾਂ ਦੀ ਪੂਰਤੀ ਮਨੁੱਖ ਜੰਗਲਾਂ ਤੋਂ ਝੌਂਪੜੀਆਂ ਨੂੰ ਛੱਡ ਕੇ ਪੱਕੇ ਘਰਾਂ ਵਿੱਚ ਨਗਰਾਂ ਦਾ ਨਿਰਮਾਣ ਕਰਨ ਲੱਗੇ ਨਾਲ ਨਾਲ ਕੰਮ ਦੀ ਗਿਣਤੀ ਵਿੱਚ ਵਾਧਾ ਹੋਇਆ ਇਹਨਾਂ ਦੀ ਵੰਡ ਦੀ ਲੋੜ ਪਈ ਵੱਖ ਵੱਖ ਕੰਮ ਨੂੰ ਸਾਂਝੇ ਢੰਗ ਨਾਲ ਕਰਨ ਦੀ ਕਈ ਸਮਿਆਂ ਵਿੱਚ ਕਈ ਸਮਿਆਂ ਵਿੱਚ ਵੰਡਿਆ ਗਿਆ ਦਿੱਤਾ ਕੀ ਹੈ ਸਰਕਿਤ ਵਿੱਚ ਹੱਥ ਨੂੰ ਕਰ ਰਿਹਾ ਜਾਂਦਾ ਹੈ ਹੱਥ ਦੇ ਨਾਲ ਨਾਲ ਅਤੇ ਹੱਥ ਦੇ ਕੀਤੇ ਕੰਮ ਨੂੰ ਕਰਨ ਲਈ ਕਿਹਾ ਜਾਂਦਾ ਹੈ ਅਤੇ ਨਾ ਉਸਨੂੰ ਕਰਨ ਲਈ ਕਿਹਾ ਜਾਂਦਾ ਹੈ ਉਸੇ ਦਿਨਾਂ ਉਸ ਨੂੰ ਕਿਹਾ ਜਾਂਦਾ ਹੈ ਜਿਸ ਕੰਮ ਤੋਂ ਕਿਸੇ ਕਿਰਤੀ ਕਰਨ ਦਾ ਨਿਰਮਾਣ ਹੁੰਦਾ ਕੈਰੀਅਰ ਔਰ ਯੋਗਦਾਨ ਜੀਵਨ ਢੰਗ ਜਿਵੇਂ ਕਿ ਸਾਡੇ ਬਰ ਜ਼ਿਲ੍ਹੇ ਬਰਨਾਲੇ ਦੇ ਵਿੱਚ ਇੱਕ ਆਊਟਲੈਟ ਨਵਾਂ ਖੁੱਲ੍ਹਿਆ ਹੈ ਜੋ ਕਿ ਇਹ ਲੋਕਾਂ ਨੂੰ ਉੱਥੇ ਰੁਜ਼ਗਾਰ ਮਿਲਿਆ ਕਈ ਦੁਕਾਨਾਂ ਖੁੱਲ੍ਹੀਆਂ ਕੋਈ ਹੋਰ ਸ਼ੋਪਾਂ ਤਿਆਰ ਹੋਈਆਂ ਉੱਥੇ ਰੁਜ਼ਗਾਰ ਮਿਲਿਆ ਲੋਕ ਕੰਮ ਕਰਨਾ ਲੱਗ ਗਏ ਇਸ ਕਰਕੇ ਸਾਡੇ ਜ਼ਿਲ੍ਹੇ ਦੇ ਵਿੱਚ ਵੀ ਬਹੁਤ ਸੁਧਾਰ ਹੋਇਆ